ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਅਸੀਂ ਤੁਹਾਡੇ ਨਾ ਰੈਸਟੋਰੈਂਟ ਤੋਂ ਖਾਣਾ ਮੰਗਵਾਇਆ ਸੀ ਅਤੇ ਉਹ ਖਾਣਾ ਤਾਂ ਠੀਕ ਨਹੀਂ ਲੱਗਿਆ ਸਾਨੂੰ ਵਿੱਚੋਂ ਸਮੈਲ ਜਿਹੀ ਆ ਰਹੀ ਸੀ ਹੁਣ ਅਸੀਂ ਤਾਂ ਤੁਹਾਡਾ ਇੰਨਾ ਨਾਮ ਸੁਣ ਕੇ ਖਾਣਾ ਔਡਰ ਕਰਿਆ ਸੀ ਸਾਨੂੰ ਕਈਆਂ ਤੋਂ ਪਤਾ ਲੱਗਿਆ ਕਿ ਬਹੁਤ ਵਧੀਆ ਖਾਣਾ ਬਣਾਉਂਦੇ ਆ ਇਹ ਬਈ ਔਡਰ ਵੀ ਅੱਛਾ ਭੇਜਦੇ ਆ ਪਰ ਸਾਡੇ ਕੋਲ ਤਾਂ ਸਹੀ ਨਹੀਂ ਆਇਆ ਹੈਗਾ ਔਡਰ ਹੁਣ ਤੁਸੀਂ ਦੱਸੋ ਇਹਦਾ ਕੀ ਕਰੀਏ ਅਸੀਂ ਤੁਸੀਂ ਸਾਨੂੰ ਜਾਂ ਤਾਂ ਰਿਫੰਡ ਕਰ ਦੋ ਸਾਡਾ ਪੈਸਾ ਜਾਂ ਫਿਰ ਸਾਨੂੰ ਕੋਈ ਹੋਰ ਇਸਦੇ ਬਦਲੇ ਕੋਈ ਹੋਰ ਖਾਣਾ ਭੇਜ ਦੋ ਅਸੀਂ ਤਾਂ ਖਾਣਾ ਖਾਣ ਲਈ ਬੈਠੇ ਹਾਂ ਅਤੇ ਵੇਟ ਕਰ ਰਹੇ ਹਾਂ ਤੁਸੀਂ ਇਹ ਬਹੁਤ ਓਹ ਕਰਿਆ ਅਸੀਂ ਤਾਂ ਬੜੀ ਉਮੀਦਾਂ ਨਾਲ ਤੁਹਾਡੇ ਤੋਂ ਮੰਗਵਾਇਆ ਸੀ ਕਿ ਬਹੁਤ ਵਧੀਆ ਖਾਣਾ ਭੇਜਦੇ ਆ ਤੁਸੀਂ ਅਤੇ ਪਲੀਜ਼ ਹੁਣ ਸਾਨੂੰ ਦੁਬਾਰਾ ਦੱਸੋ ਕੀ ਕਰੋਗੇ ਤੁਸੀਂ